ਪੰਜਾਬ ਵਿੱਚ ਅਭਿਆਸ ਕੀਤੇ ਗਏ ਵੱਖ ਵੱਖ ਧਰਮ ਸਿੱਖਿਆ ਦੇ ਮੁੱਦੇ ਨੂੰ ਧਾਰਮਿਕ ਸਕੂਲਾਂ ਦੁਆਰਾ ਪੇਸ਼ ਕਰਦੇ ਹਨ ਸਕੂਲ ਦੇ ਵਿੱਚ ਧਰਮ ਪ੍ਰਤੀ ਸਾਨੂੰ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਸਾਨੂੰ ਗੁਰੂਆਂ ਬਾਰੇ ਜਾਗਰੂਕ ਕਰਵਾਇਆ ਜਾਂਦਾ ਹੈ ਸਾਡੇ ਸਿੱਖ ਧਰਮ ਵਿੱਚ ਧਰਮ ਪ੍ਰਤੀ ਹਿੰਦੂ ਧਰਮ ਵਿੱਚ ਹਿੰਦੂ ਧਰਮ ਪ੍ਰਤੀ ਮੁਸਲਿਮ ਧਰਮ ਵਿੱਚ ਮੁਸਲਿਮ ਧਰਮ ਪ੍ਰਤੀ ਸਿੱਖਿਆ ਹੈ ਦਾ ਗਿਆਨ ਹੈ ਉਹ ਦਿੱਤਾ ਜਾਂਦਾ ਹੈ ਇੱਕ ਅਧਿਆਪਕ ਇੱਕ ਬੱਚੇ ਨੂੰ ਧਰਮ ਦੀ ਸਿੱਖਿਆ ਬੜੇ ਹੀ ਸੁਚਾਰੂ ਢੰਗ ਨਾਲ ਦਿੰਦਾ ਹੈ ਖੁਦ ਵੀ ਉਹ ਧਰਮ ਦੇ ਨਾਲ ਜੁੜਿਆ ਹੋਇਆ ਅਧਿਆਪਕ ਹੁੰਦਾ ਹੈ ਧਰਮ ਬਾਰੇ ਸਾਰੀ ਜਾਣਕਾਰੀ ਬੜੇ ਹੀ ਡੂੰਘੇ ਸ਼ਬਦਾਂ ਦੁਆਰਾ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਧਰਮ ਸਿੱਖਣ ਨਾਲ ਧਰਮ ਦਾ ਪ੍ਰਚਾਰ ਕਰਨ ਨਾਲ ਸਾਡੀ ਜ਼ਿੰਦਗੀ ਦੇ ਕਈ ਪਾਠ ਨੇ ਜੋ ਉਹ ਹੋਰ ਵੀ ਜਾਗਰੂਕ ਹੋ ਜਾਂਦੇ ਨੇ ਜਿਸ ਬਾਰੇ ਸਾਨੂੰ ਜਾਣਕਾਰੀ ਨਹੀਂ ਹੁੰਦੀ ਉਹ ਜਾਣਕਾਰੀ ਵੀ ਸਾਨੂੰ ਪ੍ਰਾਪਤ ਹੋ ਜਾਂਦੀ ਹੈ ਪੰਜਾਬ ਵਿੱਚ ਅਭਿਆਸ ਹੈ ਜਿਹੜਾ ਉਹ ਧਰਮ ਪ੍ਰਤੀ ਬਹੁਤ ਹੀ ਸੁਚਾਰੂ ਢੰਗ ਨਾਲ ਕਰਵਾਇਆ ਜਾਂਦਾ ਹੈ ਧੰਨਵਾਦ